ਪੇਂਡੂ ਲੋਕਾਂ ਲਈ ਕਾਨੂੰਨੀ ਸੇਵਾ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਬਹੁਤ ਔਖਾ ਹੈ ਕਿਉਂ ਜਿਵੇਂ ਕਿ ਉਹ ਅਦਾਲਤ ਵਿੱਚ ਜਾਂਦੇ ਹਨ ਜਾਂ ਪੁਲਿਸ ਸਟੇਸ਼ਨ ਜਾਂ ਵਕੀਲ ਨੂੰ ਮਿਲਣ ਜਾਂਦੇ ਹਨ ਤਾਂ ਜਾਂ ਤਾਂ ਉਹ ਵੱਡੇ ਅਫ਼ਸਰ ਨੂੰ ਮਿਲਦੇ ਹਨ ਅਤੇ ਉਹ ਕਹਿੰਦੇ ਹਨ ਅਤੇ ਵੱ ਵੱਡੇ ਅਫ਼ਸਰ ਸਮਝਦੇ ਹਨ ਕਿ ਉਹ ਉਹਨਾਂ ਉਹ ਪਿੰਡਾਂ ਦੇ ਲੋਕਾਂ ਨੂੰ ਅਨਪੜ੍ਹ ਹਨ ਉਹਨਾਂ ਨੂੰ ਪੜ੍ਹਨਾ ਲਿਖਣਾ ਨਹੀਂ ਆਉਂਦਾ ਇਸ ਲਈ ਉਹ ਵਾਰ ਵਾਰ ਉਹਨਾਂ ਨੂੰ ਲਾਈਨਾਂ ਵਿੱਚ ਵਾਰ ਵਾਰ ਭਜਾਉਂਦੇ ਰਹਿੰਦੇ ਹਨ ਤਾਂ ਜੋ ਉਹ ਉਹਨਾਂ ਦਾ ਕੁਛ ਨਾ ਕਰ ਸਕਣ ਪਰ ਕੁਝ ਲੋਕ ਇਹੋ ਜਿਹੇ ਵੀ ਹੁੰਦੇ ਹਨ ਪਿੰਡਾਂ ਦੇ ਲੋਕ ਬਹੁਤ ਵਧੀਆ ਹੁੰਦੇ ਹਨ ਜਿਵੇਂ ਕਿ ਉਹ ਬਹੁਤ ਸੱਚੇ ਹੁੰਦੇ ਹਨ ਕਿ ਉਹਨਾਂ ਨੂੰ ਉਹਨਾਂ ਦਾ ਹੱਕ ਨਹੀਂ ਮਿਲਦਾ ਤਾਂ ਜੋ ਉਹ ਬਹੁ ਉਹਨਾਂ ਨੂੰ ਬਹੁਤ ਮੁਸ਼ਕਲਾਂ ਆਉਂਦੀਆਂ ਹਨ ਅਦਾਲਤ ਵਿੱਚ ਜਾਣ ਲਈ ਅਤੇ ਕਈ ਲੋਕ ਝੂਠੇ ਹੋ ਕੇ ਵੀ ਸੱਚੇ ਬਣ ਜਾਂਦੇ ਹਨ ਅਤੇ ਉਹ ਝੂਠੇ ਹੋ ਕੇ ਸੱਚੇ ਬਣ ਜਾਂਦੇ ਹਨ ਅਤੇ ਉਹਨਾਂ ਦਾ ਹੱਕ ਮਾਰ ਲੈਂਦੇ ਹਨ ਅਤੇ ਇਸ ਲਈ ਸ ਉਹ ਪਿੰਡਾਂ ਦੇ ਲੋਕਾਂ ਨੂੰ ਬਹੁਤ ਮੁਸ਼ਕਲਾਂ ਆਉਂਦੀਆਂ ਹਨ ਇਸ ਲਈ ਉਹ ਕੁਛ ਕਰ ਵੀ ਨਹੀਂ ਸਕਦੇ ਕਿਉਂਕਿ ਲੋ ਅਨਪੜ੍ਹ ਉਹ ਸਮਝਦੇ ਹਨ ਪਿੰਡਾਂ ਦੇ ਲੋਕ ਅਨਪੜ੍ਹ ਹੁੰਦੇ ਹਨ ਇਸ ਲਈ ਇਹਨਾਂ ਨੂੰ ਜੋ ਮਰਜ਼ੀ ਬੋਲੋ ਇਹਨਾਂ ਨੂੰ ਕੁਛ ਸਮਝ ਨਹੀਂ ਆਉਂਦੀ ਅਤੇ ਉਹ ਵਾਰ ਵਾਰ ਪਿੰਡਾਂ ਦੇ ਲੋਕ ਇਹ ਇੱਧਰ ਉੱਧਰ ਲਾਈਨਾਂ ਵਿੱਚ ਚੱਕਰ ਮਾਰਦੇ ਰਹਿੰਦੇ ਹਨ ਅਦਾਲਤ ਚੱਕਰ ਮਾਰਦੇ ਰਹਿੰਦੇ ਹਨ ਪਰ ਉਹਨਾਂ ਨੂੰ ਕਦੀ ਅੱਜ ਤੱਕ ਆਪਣਾ ਹੱਕ ਨਹੀਂ ਮਿਲਿਆ ਕਿਉਂਕਿ ਉਹ ਬਹੁਤ ਗਰੀਬ ਵੀ ਹੁੰਦੇ ਹਨ ਇਸ ਹਿਸਾਬ ਦੇ ਗਰੀਬ ਵੀ ਹੋ ਸਕਦੇ ਕਹਿ ਸਕਦੇ ਹਾਂ ਅਤੇ ਉਹਨਾਂ ਨੂੰ ਅਨਪੜ੍ਹ ਹੁੰਦੇ ਹਨ ਤਾਂ ਜੋ ਉਹ ਪੜ੍ਹ ਨਹੀਂ ਸਕਦੇ ਇਸ ਲਈ ਉਹਨਾਂ ਨੂੰ ਪੜ੍ਹ ਨਹੀਂ ਸਕਦੇ ਅਤੇ ਉਹ ਨਾ ਕੀ ਕਹਿੰਦੇ ਆ ਪੜ੍ਹ ਨਹੀਂ ਸਕਦੇ ਅਤੇ ਉਹਨਾਂ ਨੂੰ ਆਪਣਾ ਉਹਨਾਂ ਨੂੰ ਹੱਕ ਨਹੀਂ ਮਿਲਦਾ ਇਸ ਲਈ ਮੈਂ ਪਿੰਡਾਂ ਦੇ ਲੋਕਾਂ ਨੂੰ ਅਦਾਲਤ ਵਕੀਲ ਅਤੇ ਪੁਲਿਸ ਸਟੇਸ਼ਨ ਅਤੇ ਅਦਾਲਤ ਵਿੱਚ ਜਾਣ ਲਈ ਬਹੁਤ ਮੁਸ਼ਕਲਾਂ ਅਤੇ ਤਕਲੀਫ਼ਾਂ ਆਉਂਦੀਆਂ ਹਨ